ਹੈਲੋ ਹਾਂਜੀ ਮੈਮ ਸਤਿ ਸ਼੍ਰੀ ਅਕਾਲ ਮੈਮ ਹਾਂਜੀ ਹਾਂਜੀ ਮੈਮ

ਮੈਮ ਇਹ ਇੱਥੋਂ ਜਿਹੜੀਆਂ ਟ੍ਰੇਨਸ ਜਾਂਦੇ ਨੇ ਉਹ ਅੰਬਾਲਾ ਅੰਮ੍ਰਿਤਸਰ ਆਨੰਦਪੁਰ ਸਾਹਿਬ ਐਂਡ ਲੁਧਿਆਣਾ ਊਨਾ ਇਹ ਸਿਟੀਜ਼ ਨੂੰ ਕਨੈਕਟ ਕਰਦੀਆਂ ਨੇ ਹਾਂਜੀ ਹਾਂਜੀ ਹਾਂਜੀ ਮੈਮ ਅੰਬਾਲਾ ਲਈ ਆਪਣੇ ਕੋਲ ਤਿੰਨ ਟਾਈਮਜ਼ ਜਾਂਦੀਆਂ ਸਵੇਰੇ ਦੁਪਹਿਰੇ ਔਰ ਸ਼ਾਮ ਨੂੰ ਅਤੇ ਮੇਨਲੀ ਮੈਮ ਦੁਪਹਿਰ ਵਾਲੀ ਟ੍ਰੇਨ ਕਈ ਵਾਰ ਮਿਸ ਹੋ ਜਾਂਦੀ ਇਸ ਲਈ ਆਪਾਂ ਸਵੇਰੇ ਅਤੇ ਸ਼ਾਮ ਵਾਲੀ ਨੂੰ ਤੁਸੀਂ ਟਿਕਟ ਕਰਵਾਉਣੀ ਹੈ ਤਾਂ ਸਵੇਰੇ ਵਾਲੀ ਸ਼ਾਮ ਵਾਲੀ ਕਰਵਾ ਸਕਦੇ ਹੋ ਸਵੇਰੇ ਪੰਜ ਵਜੇ ਜਾਂਦੀ ਹੈ ਔਰ ਮੈਮ ਸ਼ਾਮ ਚਾਰ ਵਜੇ ਹਾਂਜੀ ਮੈਮ ਟਿਕਟ ਦਾ ਪ੍ਰਾਈਜ਼ ਵੇਰੀ ਕਰਦਾ ਹੈ ਦੋ ਸੌ ਤੋਂ ਢਾਈ ਸੌ ਤੱਕ ਹਾਂਜੀ ਮੈਮ ਉਸ ਲਈ ਟੂ ਫਿਫ਼ਟੀ ਹਾਂਜੀ ਹਾਂਜੀ ਹਾਂਜੀ ਮੈਮ ਗੱਡੀ ਟਾਈਮ 'ਤੇ ਆਉਂਦੀ ਹੈ ਕਈ ਵਾਰ ਇੱਕ ਦੋ ਮਿੰਟ ਮਤਲਬ ਕਿ ਇੱਧਰ ਉੱਧਰ ਹੋ ਜਾਂਦੇ ਨੇ ਪਰ ਗੱਡੀ ਟਾਈਮ 'ਤੇ ਹੀ ਆਉਂਦੀ ਹੈ ਹਾਂਜੀ ਮੈਮ ਤੁਸੀਂ ਨੌਂ ਜਾਂ ਦਸ ਵਜੇ ਤੱਕ ਪੁੱਜ ਜਾਓਗੇ ਅੰਬਾਲਾ ਹਾਂਜੀ ਓਕੇ ਮੈਮ ਓਕੇ ਠੀਕ